ਹੈਲੋ ਹਾਂਜੀ ਭਾਅ ਜੀ ਹਾਂਜੀ ਹਾਂਜੀ ਜੀ ਕੀ ਹਾਲ ਜੀ ਅੱਛਾ ਅੱਛਾ ਸੰਦੀਪ ਭਾਅ ਜੀ ਨੇ ਅੱਛਾ ਠੀਕ ਹੈ ਭਾਅ ਜੀ ਅੱਛਾ ਤਾਂ ਨਹੀਂ ਇੱਥੇ ਦਾ ਭਾਅ ਜੀ ਟ੍ਰਾਂਸਪੋਰਟੇਸ਼ਨ ਬਹੁਤ ਵਧੀਆ ਹੈਗਾ ਵਾ ਤੁਸੀਂ ਜਿਹੜੇ ਜਿਹੜੇ ਲੋਕੈਲਿਟੀ ਵੱਲ ਜਾਣਾ ਹੋਏਗਾ ਨਾ ਬਸ ਮੈਨੂੰ ਇੱਕ ਵਾਰੀ ਪੁੱਛ ਲਿਓ ਭਾਵੇਂ ਮੈਂ ਤੁਹਾਨੂੰ ਗਾਈਡ ਕਰ ਦੇਵਾਂਗਾ ਬਾਕੀ ਤੁਸੀਂ ਗੱਡੀ 'ਤੇ ਵਰਕਿੰਗ ਕਰਨਾ ਪਸੰਦ ਕਰਦੇ ਹੋ ਜਾਂ ਬਾਈਕ ਬੁਈਕ 'ਤੇ ਠੀਕ ਹੈ ਠੀਕ ਹੈ ਅਤੇ ਇੰਟ ਅਗਰ ਲੁਧਿਆਣੇ ਵਗੈਰਾ ਜਾਣਾ ਪ੍ਰੈਫਰ ਹੈ ਭਾਅ ਜੀ ਫਿਰ ਤਾਂ ਟ੍ਰੇਨ ਵੀ ਤੁਹਾਨੂੰ ਵਧੀਆ ਰਹੇਗੀ ਅਤੇ ਆਪਣੀ ਗੱਡੀ ਵੀ ਬਾਏ ਰੋਡ ਵਧੀਆ ਰਹੇਗੀ ਅਗਰ ਤੁਸੀਂ ਬਾਏ ਰੋਡ ਵੀ ਜਾਂਦੇ ਹੋ ਤਾਂ ਸੜਕਾਂ ਸੁੜਕਾਂ ਬਹੁਤ ਸਾਫ ਨੇ ਮਿ ਵੱਧ ਤੋਂ ਵੱਧ ਲੁ ਅਗਰ ਤੁਸੀਂ ਪਠਾਨਕੋਟ ਵੱਲ ਵੀ ਜਾਂਦੇ ਹੋ ਡੇਢ ਘੰਟੇ ਦਾ ਪਠਾਨਕੋਟ ਦਾ ਰਸਤਾ ਜੇ ਇੱਥੋਂ ਮਿੰਟ ਰਮਾਨ ਨਾਲ ਜਾ ਸਕਦੇ ਅਗਰ ਤੁਸੀਂ ਟਰੇਨ ਵਗੈਰਾ ਪ੍ਰੈਫਰ ਕਰੋਗੇ ਫਿਰ ਤੁਹਾਨੂੰ ਡੇਢ ਘੰਟਾ ਲੱਗ ਜਾਵੇਗਾ ਬਾਕੀ ਖੁੱਲ੍ਹੀਆਂ ਬਸ ਬਹੁਤ ਵਧੀਆ ਸਰ ਬਹੁਤ ਵਧੀਆ ਰੋਡਸ ਵਗੈਰਾ ਅਗਰ ਮੈਂ ਤੁਹਾਨੂੰ ਦੱਸਾਂ ਪਠਾਨਕੋਟ ਵੱਲ ਦੀਆਂ ਲੁਧਿਆਣੇ ਵੱਲ ਦੀਆਂ ਰੋਡਜ਼ ਵਗੈਰਾ ਬਹੁਤ ਕਲੀਨ ਨੇ ਖੁੱਲ੍ਹੀਆਂ ਡੁੱਲੀਆਂ ਰੋਡਸ ਨੇ ਰਮਾਨ ਨਾਲ ਤੁਸੀਂ ਜਾ ਸਕਦੇ ਹੋ ਅਤੇ ਟਾਈਮ ਸੇਵਿੰਗ ਵੀ ਹੈਗਾ ਜੀ ਬਾਕੀ ਅਗਰ ਤੁਸੀਂ ਬਿਲਕੁਲ ਬਿਲਕੁਲ ਬਿਲਕੁਲ ਭਾਅ ਜੀ ਇਸ 'ਚ ਇਸ ਟਾਈਮ 'ਤੇ ਭਾਅ ਜੀ ਪਿੰਡਾਂ ਵਗੈਰਾ ਦੀਆਂ ਸੜਕਾਂ ਵੀ ਬੜੀਆਂ ਖੁੱਲ੍ਹੀਆਂ ਡੁੱਲੀਆਂ ਬਣੀਆਂ ਤੁਸੀਂ ਰਮਾਨ ਨਾਲ ਗੱਡੀ ਵਗੈਰਾ ਲੈ ਕੇ ਕਿਸੇ ਦੇ ਵੀ ਘਰ ਜਾ ਸਕਦੇ ਜਾਂ ਕਿਸੇ ਦੀ ਸ਼ੋਪ ਵਗੈਰਾ 'ਤੇ ਜਾ ਸਕਦੇ ਹੋ ਬੜੇ ਅਰਾਮ ਨਾਲ ਕੋਈ ਚੱਕਰ ਹੀ ਨਹੀਂ ਐਵੇਂ ਦਾ ਚਲੋ ਚਲੋ ਬਹੁਤ ਬਹੁਤ ਬਹੁਤ ਮਿਹਰਬਾਨੀ ਜਨਾਬ ਉਹਨਾਂ ਦੀ ਕਿ ਉਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਬਹੁਤ ਬਹੁਤ ਵਧੀਆ ਭਾਅ ਜੀ ਬਾਕੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਜ਼ਰੂਰ ਜਦੋਂ ਮਰਜ਼ੀ ਕੋਲ ਕਰ ਲਿਓ ਭਾਅ ਜੀ ਠੀਕ ਹੈ ਭਾਅ ਜੀ ਬ ਥੈਂਕ ਯੂ ਭਾਅ ਜੀ